ਬਈਕਿੰਗ ਮੈਨੂੰ ਸ਼ੁਰੂ ਤੋਂ ਹੀ ਪਸੰਦ ਸੀ ਪਹਿਲਾਂ ਮੈਂ ਔਨਲਾਈਨ ਯੂਟਿਊਬ 'ਤੇ ਕਈ ਵਲੋਗਰਸ ਨੂੰ ਦੇਖਦਾ ਸੀ ਜੋ ਬਾਈਕ ਰਾਈਡਿੰਗ ਕਰਦੇ ਸੀ ਅਤੇ ਅਲੱਗ ਅਲੱਗ ਜਗਾਵਾਂ 'ਤੇ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਅਲੱਗ ਹੀ ਚਾਅ ਹੁੰਦਾ ਸੀ ਹੌਲੀ ਹੌਲੀ ਮੈਂ ਬਾਈਕ ਚਲਾਉਣੀ ਸਿੱਖੀ ਆਪਣੇ ਘਰਦਿਆਂ ਤੋਂ ਅਤੇ ਦੋਸਤਾਂ ਤੋਂ ਬਾਈਕ ਚਲਾਉਣ ਤੋਂ ਬਾਅਦ ਮੈਂ ਸਫ਼ਰ ਆਪਣਾ ਸ਼ੁਰੂ ਕੀਤਾ ਮੈਂ ਅਲੱਗ ਅਲੱਗ ਜਗਾਵਾਂ 'ਤੇ ਜਾਂਦਾ ਉਹਨਾਂ ਨੂੰ ਐਕਸਪਲੋਰ ਕਰਦਾ ਤਾਂ ਇਸ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਸਾਲਾਂ ਦੌਰਾਨ ਮੈਂ ਆਪਣੀ ਬਾਈਕਿੰਗ ਦਾ ਜਨੂੰਨ ਵਧਾਉਂਦਾ ਹੀ ਗਿਆ ਹੁਣ ਵੀ ਮੇਰਾ ਐਂ ਹੁੰਦਾ ਵੀ ਮੈਂ ਲੰਬੇ ਲੰਬੇ ਰਾਹਵਾਂ 'ਤੇ ਬਾਈਕਿੰਗ ਕਰਾਂ